ਹਾਂਜੀ ਸਰ ਹੈਲੋ ਹਾਂਜੀ ਹਾਂਜੀ ਸਰ ਹਾਂਜੀ ਸਰ ਅਵੇਲੇਬਲ ਹੈ ਤੁਸੀਂ ਦੱਸੋ ਕੀ ਓਡਰ ਕਰਾਉਣਾ ਹਾਂਜੀ ਹਾਂਜੀ ਜਿਵੇਂ ਮਤਲਬ ਬਈ ਸਟੋਲ ਲਵਾਉਣਾ ਤੁਸੀਂ ਹਾਂਜੀ ਸਰ ਕਿੰਨੇ ਪਰਸਨ ਆ ਦੋ ਹਜ਼ਾਰ ਪਰਸਨ ਠੀਕ ਹੈ ਜੀ ਕੋਈ ਨਾ ਸਰ ਲਵਾਦਾਂਗੇ ਕਿੱਥੇ ਹੈ ਸਰ ਓਕੇ ਓਕੇ ਸਰ ਲਵਾਦਾਂਗੇ ਅਤੇ ਆਪਣੇ ਕੋਲੇ ਬਹੁਤ ਸਾਰੇ ਫਲੇਵਰ ਮਿਲ ਜਾਂਦੇ ਆ ਅਤੇ ਡਿਸ਼ਿਸ ਵਗੈਰਾ ਵੀ ਨਾਲ ਲੈਣੀਆਂ ਤੁਸੀਂ ਆਪਾਂ ਨੂੰ ਇਹਨੂੰ ਫਿਰ ਚਾਹ ਦੇ ਨਾਲ ਆਪਾਂ ਕੱਪ ਕੇਕ ਦਿੰਦੇ ਹਾਂ ਅਤੇ ਸ਼ੂਗਰ ਦਿੰਦੇ ਹਾਂ ਇਹ ਆਪਾਂ ਨੂੰ ਇਹ ਡੇ ਮਤਲਬ ਕਿ ਕੋਂਬੋ ਆਪਾਂ ਨੂੰ ਪੰਜਾਹ ਰੁਪਏ 'ਚ ਪੈ ਜਾਂਦਾ ਆਪਣੇ ਅਤੇ ਆਪਾਂ ਇਹ ਵੀ ਲਾ ਸਕਦੇ ਹਾਂ ਅਤੇ ਦੂਜਾ ਕੋਂਬੋ ਆਪਣਾ ਚਾਏ ਦੇ ਨਾਲ ਪੈਟੀ ਇਹ ਵੀ ਮਤਲਬ ਕੇ ਸੱਠ ਕੁ ਰੁਪਏ 'ਚ ਲੱਗ ਜਾਂਦਾ ਅਤੇ ਫਲੇਵਰਸ ਸਰ ਆਪਾਂ ਚਾਏ ਦੇ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ ਚਾਏ ਦੇ ਫਲੇਵਰਸ ਇਲਾਇਚੀ ਫਲੇਵਰ ਹਾਰਡ ਅਦਰਕ ਨੋਰਮਲ ਅਦਰਕ ਕੇਸਰ ਪਿਸਤਾ ਠੀਕ ਹੈ ਜੀ ਔਰ ਕੁੱਲੜ ਚਾਏ ਮਿਲਜੂਗੀ ਤੁਹਾਨੂੰ ਮਤਲਬ ਕਿ ਓਲ ਚਾਹ ਤਾਂ ਵੈਸੇ ਕੁੱਲੜਾਂ 'ਚ ਮਿਲਣਗੇ ਵੈਸੇ ਕੁੱਲੜ ਚਾਏ ਆਪਾਂ ਸਪੈਸ਼ਲ ਬਣਾਉਣੇ ਹਾਂ ਠੀਕ ਹੈ ਗੁੜ ਚਾਏ ਮਿਲਜੂਗੀ ਆਪਾਂ ਨੂੰ ਵਾਵਾ ਵਿਰਾਇਟੀ ਦੀ ਆਪਣੇ ਕੋਲੇ ਚਾਹ ਚਾਹ ਅਵੇਲੇਬਲ ਹੈ ਹਾਂਜੀ ਹਾਂਜੀ ਆਪਾਂ ਨੂੰ ਪਰ ਪਰਸਨ ਪਊਗਾ ਵੀਹ ਰੁਪਏ ਲਾਦਾਂਗੇ ਸਰ ਤੁਹਾਨੂੰ ਕੋਈ ਚੱਕਰ ਨਹੀਂ ਹਾਂਜੀ ਸਰ ਹਾਂਜੀ ਸਰ ਕਰਲਾਂਗੇ ਸਰ ਮੌਕੇ 'ਤੇ ਕਰਲਾਂਗੇ ਆਪਾਂ ਸਾਰਾ ਕੁਛ ਕਰਲਾਂਗੇ ਸਰ ਤੁਸੀਂ ਦੱਸੋ ਕਿ ਕਦੋਂ ਲਵਾਉਣਾ ਪੰਦਰਾਂ ਤਰੀਕ ਪੰਦਰਾਂ ਨਵੰਬਰ ਓਕੇ ਪੰਦਰਾਂ ਨਵੰਬਰ ਠੀਕ ਹੈ ਸਰ ਆਪਾਂ ਚੌਦਾਂ ਨੂੰ ਉੱਥੇ ਜਾ ਕੇ ਆਪਾਂ ਸੈਟਿੰਗ ਕਰਦਾਂਗੇ ਅਤੇ ਤੁਹਾਨੂੰ ਕੋਂਬੋ ਦੱਸ ਦਿੰਦਾ ਕਿੰਨੇ ਕਿੰਨੇ 'ਚ ਪੈਜੂਗਾ ਤੁਹਾਨੂੰ ਜਿਹੜਾ ਕੱਪ ਕੇ ਵਾਲਾ ਕੋਂਬੋ ਆ ਉਹ ਤੁਹਾਨੂੰ ਪੈਜੂਗਾ ਤੀਹ ਰੁਪਏ 'ਚ ਜਿਹੜਾ ਪੈਟੀ ਵਾਲਾ ਕੋਂਬੋ ਆ ਉਹ ਤੁਹਾਨੂੰ ਚਾਲੀ ਰੁਪਏ 'ਚ ਪੈਜੂਗਾ ਜੀ ਹਾਂਜੀ ਸਰ ਹੋਰ ਕੁਛ ਹਾਂਜੀ ਹਾਂਜੀ ਸੇਮ ਸੇਮ ਸਰ ਤੀਹ ਰੁਪਈਏ ਹਾਂ ਹਾਂਜੀ ਹਾਂਜੀ ਸਰ ਸੇਮ ਪ੍ਰਾਈਜ਼ ਹੈ ਜੀ ਸਾਰਿਆਂ ਦੇ ਮਤਲਬ ਕੀ ਅੱਛਾ ਫਲੇਵਰਸ ਦੇ ਪੁੱਛਦੇ ਹੋ ਤਾਂ ਫਲੇਵਰਸ ਦੇ ਸਰ ਹਾਂਜੀ ਆਪਣੇ ਅਲੱਗ ਅਲੱਗ ਹੈ ਇੱਕ ਤਾਂ ਆਪਾਂ ਨੂੰ ਕੋਸਟਲੀ ਪੈ ਜਾਂਦਾ ਇੱਕ ਕੇਸਰ ਚਾਏ ਅਤੇ ਦੂਸਰਾ ਪੈ ਜਾਂਦਾ ਆਪਣੇ ਇੱਕ ਅਦਰਕ ਵਾਲੀ ਚਾਏ ਵੀ ਆਪਾਂ ਨੂੰ ਕੋਸਟਲੀ ਪੈ ਜਾਂਦੀ ਹੈ ਅਤੇ ਅਤੇ ਗੁੜ ਵਾਲੀ ਚਾਏ ਆਪਣੀ ਸਪੈਸ਼ਲੀ ਹੁੰਦੀ ਹੈ ਅਤੇ ਉਹ ਵੀ ਕੋਸਟਲੀ ਪੈ ਜਾਂਦੀ ਹੈ ਮਤਲਬ ਕਿ ਪੰਤਾਲੀ ਪੰਤਾਲੀ ਰੁਪਏ ਦਾ ਇੱਕ ਕੱਪ ਹੁੰਦਾ ਇਨ੍ਹਾਂ ਦਾ ਜੀ ਆਪਣੀ ਟੋਟਲ ਕੋਸਟਿੰਗ ਆਪਾਂ ਆ ਜਾਣੀ ਆਪਾਂ ਨੂੰ ਦੋ ਹਜ਼ਾਰ ਪਰਸਨ ਹੈ ਮਤਲਬ ਕਿ ਅੱਸੀ ਕੁ ਹਜ਼ਾਰ ਤੁਹਾਡੀ ਕੋਸਟਲੀ ਆਜੂਗੀ ਹਾਂਜੀ ਹਾਂਜੀ ਹਾਂਜੀ ਸਾਰਾ ਕੁਛ ਅਰੇਂਜਮੈਂਟ ਆਪਾਂ ਕਰਕੇ ਦੇਵਾਂਗੇ ਤੁਹਾਨੂੰ ਆਪਣੇ ਬੰਦੇ ਦੇਵਾਂਗੇ ਤੁਹਾਨੂੰ ਉਹ ਤੁਹਾਨੂੰ ਚਾਏ ਸਰਵ ਕਰਨਗੇ ਜੀ ਹਾਂਜੀ ਸਰ ਆਪਣੇ ਹੋਣਗੇ ਸਰ ਆਪਣੇ ਹੋਣਗੇ ਹਾਂਜੀ ਸਰ ਠੀਕ ਹੈ ਸਰ ਤੁਸੀਂ ਮੈਨੂੰ ਦੱਸ ਦਿਓ ਕੌਲ ਕਰਕੇ ਤੁਸੀਂ ਨੰਬਰ ਸੇਵ ਕਰ ਲਿਓ ਠੀਕ ਹੈ ਸਰ ਓਕੇ ਸਰ